ਇੱਕੀ ਜਨਵਰੀ ਦੋ ਹਜ਼ਾਰ ਦੋ ਅੱਠ ਫਰਵਰੀ ਦੋ ਹਜ਼ਾਰ ਬਾਈ ਦਸ ਦਸੰਬਰ ਉੱਨੀ ਸੌ ਅਠਾਨਵੇਂ ਇੱਕੀ ਮਾਰਚ ਉੱਨੀ ਸੌ ਚੁਰਾਸੀ ਬਾਈ ਦਸੰਬਰ ਦੋ ਹਜ਼ਾਰ ਦੋ